ਮੈਨੂੰ ਸ਼ੁਰੂ ਤੋਂ ਹੀ ਪੇਂਟਿੰਗ ਸਿੱਖਣ ਦਾ ਬਹੁਤ ਸ਼ੌਕ ਸੀ ਸਾਡਾ ਪੇਂਟਿੰਗ ਦਾ ਇੱਕ ਵੱਖਰਾ ਪੀਰੀਅਡ ਲੱਗਦਾ ਹੁੰਦਾ ਸੀ ਅਤੇ ਮੈਂ ਬਹੁਤ ਉਤਸ਼ਾਹਿਤ ਹੁੰਦੀ ਸੀ ਪੇਂਟਿੰਗ ਜਦੋਂ ਮੈਡਮ ਕਰਵਾਉਂਦੇ ਹੁੰਦੇ ਸੀ ਮੈਂ ਬਹੁਤ ਉਤਸ਼ਾਹਿਤ ਹੁੰਦੀ ਸੀ ਕੁਛ ਨਵਾਂ ਨਵਾਂ ਸਿੱਖਣ ਲਈ ਘਰ ਆ ਕੇ ਵੀ ਮੈਂ ਕੁਛ ਟਰਾਈ ਕਰਦੀ ਰਹਿੰਦੀ ਹੁੰਦੀ ਸੀ ਨਵਾਂ ਨਵਾਂ ਬਣਾਉਣ ਵਾਸਤੇ ਫਰੀ ਟਾਈਮ ਲਈ ਆਪਣਾ ਕੋਈ ਨਾ ਕੋਈ ਬਣਾਉਂਦੇ ਰਹਿਣਾ ਕਿ ਮੈਂ ਹੱਥ ਮੇਰਾ ਖੁੱਲ੍ਹਦਾ ਰਹੇ ਅਤੇ ਉਸ ਵਿੱਚੋਂ ਮੈਨੂੰ ਅਗਾਂਹ ਅਗਾਂਹ ਜਾ ਕੇ ਕਾਫੀ ਐਕਸਪੀਰੀਅੰਸ ਆਉਂਦਾ ਗਿਆ ਅਤੇ ਇੱਕ ਵਾਰ ਸਾਡੇ ਸਕੂਲ ਵਿੱਚ ਬਾਹਰੋਂ ਬਾਹਰੋਂ ਪੇਂਟਿੰਗ ਸਿਖਾਉਣ ਵਾਸਤੇ ਟੀਚਰ ਵੀ ਆਏ ਸੀ ਅਤੇ ਉਹਨਾਂ ਨੇ ਮੈਨੂੰ ਮਦਰਸ ਡੇਅ 'ਤੇ ਮਦਰ ਦੀ ਪੇਂਟਿੰਗ ਬਣਾਉਣੀ ਸਾਨੂੰ ਸਿਖਾਈ ਮੈਨੂੰ ਉਹ ਬਹੁਤ ਵਧੀਆ ਲੱਗੀ ਮੈਂ ਹਾਂ ਉਹ ਤਜ਼ਰਬਾ ਮੇਰੇ ਲਈ ਬਹੁਤ ਲਾਭਦਾਇਕ ਰਿਹਾ ਯਾਦਗਾਰ ਲਾਭਦਾਇਕ ਰਿਹਾ ਅਗਾਂਹ ਜਾ ਕੇ ਮੇਰੇ ਕੋਲੇਜ ਟਾਈਮ 'ਤੇ ਕੋਲੇਜ ਲਾਈਫ ਵਿੱਚ ਕੰਪੀਟੀਸ਼ਨ 'ਚ ਮੈਂ ਉਹੀ ਮਦਰ ਦੀ ਫੋਟੋ ਪਿਚਰ ਕੀਤੀ ਅਤੇ ਬਣਾਈ ਬਹੁਤ ਸੋਹਣੇ ਢੰਗ ਨਾਲ ਉਹ ਬਣੀ ਅਤੇ ਮੈਨੂੰ ਉਹਦੇ ਵਿੱਚ ਫਸਟ ਪ੍ਰਾਈਜ਼ ਮਿਲਿਆ ਜਿਹਦੇ ਨਾਲ ਕਿ ਮੇਰੀ ਬਹੁਤ ਪ੍ਰਸ਼ੰਸਾ ਹੋਈ ਅਤੇ ਮੈਨੂੰ ਸਾਰੇ ਬਹੁਤ ਖੁਸ਼ ਹੋਏ ਵੇਖ ਕੇ ਇਸ ਤਰ੍ਹਾਂ ਮੈਨੂੰ ਪੇਂਟਿੰਗ ਦੇ ਵਿੱਚ ਬਹੁਤ ਸਾਰਾ ਘਰ ਦਿਲਚਸਪ ਤਜ਼ਰਬੇ ਦੇ ਨਾਲ ਮੈਂ ਪੇਂਟਿੰਗ ਕਰਦੀ ਹਾਂ ਵੱਖ ਵੱਖ ਤਰ੍ਹਾਂ ਦੀਆਂ ਚਾਦਰਾਂ 'ਤੇ ਕੀਤੀਆਂ ਜਿਸ ਤਰ੍ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਪਰਛੱਤੀਆਂ 'ਤੇ ਅਸੀਂ ਛਾੜੇ ਵਿਛਾਉਂਦੇ ਹੁੰਦੇ ਸੀ ਸਿਰਹਾਣਿਆਂ 'ਤੇ ਸੋਫਿਆਂ 'ਤੇ ਗੱਦਿਆਂ ਗੱਦ ਗੱਦੀਆਂ ਦੇ ਕਵਰਾਂ 'ਤੇ ਉਸ ਬਣਾ ਬਣਾ ਕੇ ਬਹੁਤ ਐਕਸਪੀਰੀਅੰਸ ਮੇਰਾ ਵੱਧ ਗਿਆ ਹੈ